ਪੇਸ਼ਵਰ ਤੈਰਾਕੀ ਰਵਾਨੀਤੀ ਤੈਰਾਕੀ ਨਾਲ਼ੋਂ ਬਹੁਤ ਵੱਖਰੀ ਹਨ ਕਿਉਂਕਿ ਇੱਕ ਵਿੱਚ ਉਲਟਾ ਦੌੜ ਉਲਟੀ ਸਵਿਮਿੰਗ ਕਰਦੇ ਹਨ ਅਤੇ ਅਤੇ ਇੱਕ ਵਿੱਚ ਸਿੱਧੀ ਤੈਰਾਕੀ ਮਾਰਦੇ ਹਨ ਅਤੇ ਸਵਿਮਿੰਗ ਵੀ ਤੈਰਾਕੀ ਹੀ ਹੁੰਦੀ ਹਨ ਤੈਰਾਕੀ ਨੂੰ ਇੰਗਲਿਸ਼ 'ਚ ਸਵਿਮਿੰਗ ਕਿਹਾ ਜਾਂਦਾ ਹੈ ਪੇਸ਼ਵਰ ਤੈਰਾਕੀ ਬਹੁਤ ਹੀ ਔਖੀ ਹੁੰਦੀ ਹੈ ਪਰ ਰਵਾਇਤੀ ਤੈਰਾਕੀ ਵੀ ਔਖੀ ਹੁੰਦੀ ਹਨ ਪਰ ਪੇਸ਼ਵਾਰ ਤੈਰਾਕੀ ਨੂੰ ਜ਼ਿਆਦਾਤਰ ਲੋਕ ਕਰ ਲੈਂਦੇ ਹਨ ਮੈਂ ਵੀ ਇੱਕ ਵਾਰ ਮੈਂ ਵੀ ਇੱਕ ਵਾਰ ਸਵਿਮਿੰਗ ਪੂਲ ਵਿੱਚ ਗਿਆ ਸੀ ਅਤੇ ਉੱਥੇ ਮੈਂ ਡੁੱਬਣੇ ਵਾਲਾ ਸੀ ਫਿਰ ਮੇਰੇ ਦੋਸਤਾਂ ਨੇ ਮੈਨੂੰ ਬਚਾ ਲਿਆ ਸੀ ਅਤੇ ਇਹ ਫਿਰ ਉਸ ਤੋਂ ਬਾਅਦ ਮੈਂ ਨਦੀ ਵਿਚ ਨਹਾਉਣਾ ਪਸੰਦ ਕਰਦਾ ਸੀ ਫਿਰ ਮੈਨੂੰ ਆਦਤ ਪੈ ਗਈ ਸੀ ਨਹਾਉਣੇ ਦੀ ਆਦਤ ਪੈ ਗਈ ਸੀ ਫਿਰ ਮੈਨੂੰ ਡਰ ਨਹੀਂ ਲੱਗਦਾ ਸੀ ਫਿਰ ਮੈਂ ਉੱਚੇ ਤੋਂ ਉੱਚੇ ਖੰਭਿਆਂ ਤੋਂ ਵੀ ਚੱਟਾਨਾਂ ਤੋਂ ਵੀ ਛਲਾਂਗ ਮਾਰ ਲੈਂਦਾ ਸੀ ਅਤੇ ਹੁਣ ਮੈਂ ਸਵਿਮਿੰਗ ਵਿੱਚ ਇੱਦਾਂ ਐਕਸਪਰਟ ਬਣ ਗਿਆ ਹਾਂ ਕਿ ਮੈਨੂੰ ਕੋਈ ਵੀ ਨਹੀਂ ਹਰਾ ਸਕਦਾ ਹੈ